ਹਾਂਜੀ ਪੰਜਾਬ ਦੇ ਵਿੱਚ ਜੋ ਹੈ ਚਾਵਲ ਅਤੇ ਕਣਕ ਜਿਹੜੀ ਹੈ ਬਹੁਤ ਵੱਧ ਮਾਤਰਾਂ ਦੇ ਵਿੱਚ ਉਗਾਈ ਜਾਂਦੀ ਹੈ ਕਿਉਂਕਿ ਇੱਥੇ ਵੱਧ ਪੱਧਰ 'ਚ ਜਿਹੜਾ ਇਹ ਪੇਂਡੂ ਖੇਤਰ ਜੋ ਹੈ ਉਹ ਵੇਖਣ ਨੂੰ ਮਿਲਦਾ ਹੈ ਅਤੇ ਲੋਕਾਂ ਨੂੰ ਰੁਚੀ ਵੀ ਹੈ ਲੋਕ ਬੜੀ ਮਤਲਬ ਰੁਚੀ ਦੇ ਨਾਲ ਜੈ ਫ਼ਸਲਾਂ ਪੈਦਾ ਕਰਦੇ ਹਾਂ ਹਨ ਅਤੇ ਇਸ ਤੋਂ ਇਲਾਵਾ ਜੋ ਹੈ ਉਹ ਪਸ਼ੂ ਵੀ ਰੱਖਦੇ ਹਨ ਜੇਕਰ ਉਹਨਾਂ ਨੇ ਖੇਤੀਬਾੜੀ ਕਰਨੀ ਹੈ ਤਾਂ ਪਸ਼ੂ ਜਿਵੇਂ ਹੋ ਗਿਆ ਬਲਦ ਰੱਖਦੇ ਨੇ ਤੇ ਹੋ ਗਈ ਗਾਂ ਮੱਝਾਂ ਇਹ ਸਾਰੀਆਂ ਰੱਖਦੇ ਨੇ ਉਹਨਾਂ ਤੋਂ ਜਿਵੇਂ ਉਹ ਲੋਕ ਲੋਕਾਂ ਨੂੰ ਦੁੱਧ ਵੀ ਮਤਲਬ ਉਹਨਾਂ ਦਾ ਦੁੱਧ ਜਿਹੜਾ ਸੇਲ ਕਰਦੇ ਨੇ ਅਤੇ ਬੜੇ ਮਤਲਬ ਲੋ ਓ ਦੂਰ ਦੂਰ ਜਾ ਕੇ ਜਿਹੜੇ ਆਪਣੀ ਆਪਣਾ ਜਿਹੜਾ ਡੇਰੀ ਦਾ ਕੰਮ ਕਰਦੇ ਨੇ ਬੜੇ ਲੋਕਾਂ ਨੇ ਜਿਵੇਂ ਪਸ਼ੂ ਰੱਖੇ ਨੇ ਵ ਵਧੀਆ ਡੇਰੀ ਚਲਾ ਰਹੇ ਨੇ ਪਨੀਰ ਦੁੱਧ ਸਾਰਾ ਡੇਰੀ ਦਾ ਕੰਮ ਉਹਨਾਂ ਨੇ ਰੱਖਿਆ ਹੋਇਆ ਹੈ ਇਸ ਤਰੀਕੇ ਦੇ ਨਾਲ ਮਤਲਬ ਉਹ ਕਾਫੀ ਇੱਥੇ ਮਤਲਬ ਹਰਿਆਲੀ ਵੇਖਣ ਨੂੰ ਮਿਲਦੀ ਹੈ ਅਤੇ ਲੋਕ ਸ ਜ਼ਰੂਰੀ ਅ ਚਾਵਲ ਅਤੇ ਕਣਕ ਤਾਂ ਪੈਦਾ ਹੋ ਰਹੀ ਹੈ ਇਸ ਤੋਂ ਇਲਾਵਾ ਇੱਥੇ ਜੋ ਬਹੁਤ ਸਾਰੀਆਂ ਸਬਜ਼ੀਆਂ ਵੀ ਪੈਦਾ ਕੀ ਪੈਦਾਵਾਰ ਜਿਹੜੀ ਆ ਉਹ ਜ਼ਿਆਦਾ ਇਹ ਸਰਦੀਆਂ ਦੇ ਵਿੱਚ ਵੀ ਬਹੁਤ ਵਧੀਆ ਵਧੀਆ ਸਬਜ਼ੀਆਂ ਤੁਹਾਨੂੰ ਜਿਹੜੀਆਂ ਹੈ ਇਹ ਵੇਖਣ ਨੂੰ ਖਾਣ ਨੂੰ ਮਿਲਦੀਆਂ ਹਨ